ਮੈਂ ਇੱਕ ਹੂਡੀ ਲੈਣਾ ਚਾਹੁੰਦੀ ਹਾਂ ਜਿਸ ਦਾ ਰੰਗ ਲਾਲ ਅਤੇ ਸਾਈਜ਼ ਐਕਸਅਲ ਹੋਵੇ ਮੈਂ ਸੋਚ ਰਹੀ ਹਾਂ ਕਿ ਮੈਂ ਐਮਾਜ਼ੋਨ 'ਤੇ ਉਸਦੀ ਭਾਲ ਕਰਾਂ ਕਿਉਂਕਿ ਐਮਾਜ਼ੋਨ ਇੱਕ ਵਧੀਆ ਬਹੁਤ ਹੀ ਵਧੀਆ ਬ੍ਰੈਂਡ ਹੈ ਜਿੱਥੇ ਕਿ ਮੈਨੂੰ ਇਹ ਬਹੁਤ ਹੀ ਵਧੀਆ ਕੱਪੜੇ ਜਿਵੇਂ ਕਿ ਕੋਟਨ ਦੇ ਕੱਪੜੇ ਵਿੱਚ ਮੈਨੂੰ ਇੱਕ ਗਰਮ ਹੂ਼ਡੀ ਦੀ ਭਾਲ ਹੈ ਅਤੇ ਮੈਂ ਸਭ ਕੁਛ ਵੇਖ ਕੇ ਅੱਛੀ ਤਰ੍ਹਾਂ ਜਾਂਚ ਕਰਕੇ ਹੀ ਲੈਣਾ ਚਾਵਾਂਗੀ ਮੈਂ ਉਸਦਾ ਸਾਈਜ਼ ਉਸਦਾ ਰੰਗ ਉਸਦਾ ਕੱਪੜਾ ਅਤੇ ਉਸਦੀ ਬਣਾਵਟ ਸਭ ਕੁਛ ਦੇਖਭਾਲ ਕੇ ਹੀ ਲਵਾਂਗੀ ਮੈਨੂੰ ਬਹੁਤ ਹੀ ਦਿਨਾਂ ਤੋਂ ਇਸਦੀ ਭਾਲ ਸੀ ਅਤੇ ਮੈਂ ਇਹ ਐਮਾਜ਼ੋਨ 'ਤੇ ਦੇਖਿਆ ਸੀ ਮੈਂ ਇਸਨੂੰ ਆਰਡਰ ਕਰਨਾ ਚਾਹੁੰਦੀ ਹਾਂ ਇਹ ਬਹੁਤ ਹੀ ਸੋਹਣਾ ਸੀ ਅਤੇ ਮੈਂ ਆਰਡਰ ਦੇਣਾ ਚਾਹੁੰਦੀ ਹਾਂ ਐਮਾਜ਼ੋਨ ਇੱਕ ਬਹੁਤ ਹੀ ਵਧੀਆ ਬ੍ਰੈਂਡ ਹੈ ਧੰਨਵਾਦ